ਮੇਰਾ ਘਰ ਅੰਬਰਸਰ ਵਿੱਚ ਹੈ ਅਤੇ ਮੇਰੇ ਘਰ ਦੇ ਨੇੜੇ ਇੱਕ ਪਾਰਕ ਹੈ ਜਿਸ ਵਿੱਚ ਛੋਟੇ ਬੱਚੇ ਆ ਕੇ ਖੇਡਦੇ ਹਨ ਅਤੇ ਬੁੱਢੇ ਲੋਕ ਸੈਰ ਸਪਾਟਾ ਕਰਦੇ ਹਨ ਮੇਰੇ ਘਰ ਦੇ ਨੇੜੇ ਪਾਰਕ ਦੇ ਨਾਲ ਨਾਲ ਇੱਕ ਰੇਹੜੀਆਂ ਵੀ ਹਨ ਜਿਸ ਵਿੱਚ ਤਿੰਨ ਰੇਹੜੀਆਂ ਦੇ ਵਿੱਚ ਉੱਥੋਂ ਦੇ ਮੋਮੋਜ ਅਤੇ ਸਪਰਿੰਗ ਰੋਲ ਉਹਨਾਂ ਦੀ ਸ਼ਾਨ ਹੈ ਹਰ ਦਿਨ ਲੰਬੀ ਲੰਬੀ ਲਾਈਨਾਂ ਲੱਗੀਆਂ ਹੁੰਦੀਆਂ ਹਨ ਅਤੇ ਉੱਥੋਂ ਲੋਕ ਇਹ ਖਾਣਾ ਬਹੁਤ ਪਸੰਦ ਕਰਦੇ ਹਨ ਫੇਰ ਉਸ ਰੇਹੜੀਆਂ ਦੇ ਨੇੜੇ ਕੁਛ ਦੁਕਾਨਾਂ ਹਨ ਜਿਨ੍ਹਾਂ ਵਿੱਚ ਬਹੁਤ ਹੀ ਵਿਕਰੀ ਹੁੰਦੀ ਹੈ ਲੋਕ ਜ਼ਿਆਦਾਤਰ ਕੱਪੜੇ ਦੁਕਾਨਾਂ ਵਿੱਚ ਰਹਿਣਾ ਪਸੰਦ ਕਰਦੇ ਹਨ ਜਿੱਥੇ ਉਹ ਕੁੜਤਾ ਪਜਾਮਾ ਖਰੀਦਦੇ ਹਨ ਅਤੇ ਇਸ ਕੁੜਤੇ ਪਜਾਮੇ ਦਾ ਟ੍ਰੈਂਡ ਬਹੁਤ ਹੀ ਫੈਲਿਆ ਹੋਇਆ ਹੈ ਪੰਜਾਬ ਵਿੱਚ ਹਰ ਇੱਕ ਘਰ ਵਿੱਚ ਕੁੜਤਾ ਪਜਾਮਾ ਹੁੰਦਾ ਹੈ ਲੋਕ ਬਾਹਰਲੇ ਦੇਸ਼ਾਂ ਤੋਂ ਆ ਕੇ ਕੁੜਤਾ ਪਜਾਮਾ ਖਰੀਦਦੇ ਹਨ ਅਤੇ ਇੱਥੇ ਵਿਖਾਉਂਦੇ ਹਨ ਫੇਰ ਮੇਰੇ ਘਰ ਦੇ ਥੋੜ੍ਹਾ ਜਿਹਾ ਨੇੜੇ ਹਰਿਮੰਦਰ ਸਾਹਿਬ ਆਉਂਦਾ ਹੈ ਲੋਕ ਦੂਰ ਦੂਰ ਤੋਂ ਆ ਕੇ ਇੱਥੇ ਲੰਗਰ ਛਕਦੇ ਹਨ ਅਤੇ ਇੱਥੇ ਦੀ ਸੰਸਕ੍ਰਿਤੀ ਨੂੰ ਪਹਿਚਾਣਦੇ ਹਨ ਇੱਥੇ ਦੀਆਂ ਟਾਈਲਾਂ ਉੱਤੇ ਹਰ ਭਾਸ਼ਾ ਵਿੱਚ ਸਾਡਾ ਕਲਚਰ ਲਿਖਿਆ ਹੋਇਆ ਹੈ ਕਿ ਕੋਈ ਵੀ ਆਦਮੀ ਉਸ ਨੂੰ ਆਪਣੀ ਭਾਸ਼ਾ ਵਿੱਚ ਪੜ੍ਹ ਸਕੇ ਲੋਕ ਇੱਥੇ ਆਉਂਦੇ ਹਨ ਸ਼ਰਧਾਲੂ ਬਣਦੇ ਹਨ